ਸਤਿ ਸ਼੍ਰੀ ਅਕਾਲ ਜੀ ਮੇਰੀ ਪਸੰਦੀਦਾ ਜਿਹੜੀ ਹੈਗੀ ਆ ਪਕਵਾਨ ਉਹ ਬੰਬ ਪਕੌੜਾ ਹੈ ਜੋ ਅਸੀਂ ਬ੍ਰੈਡਾਂ 'ਤੇ ਆਲੂਆਂ ਦਾ ਮਿਕਸ਼ ਮਿਸ਼ਰਨ ਬਣਾਉਨੇ ਹਾਂ ਬੇਸਨ ਵਿੱਚ ਲਬੇੜ ਕੇ ਤੇਲ ਵਿੱਚ ਤਲ ਕੇ ਉਹ ਬਹੁਤ ਬਹੁਤ ਸਵਾਦ ਬਣਦਾ ਅਤੇ ਉਹਨੂੰ ਖਾ ਕੇ ਨਾ ਐਨ ਵਧੀਆ ਰੱਜ ਜਾਈਦਾ ਅਤੇ ਠੰਡ ਵਿੱਚ ਤਾਂ ਉਹ ਉਦੋਂ ਵੀ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਉਹ ਗਰਮ ਹੁੰਦਾ ਨਾ ਫਿਰ ਅਸੀਂ ਉਹ ਸਰਦੀਆਂ ਦੇ ਮੌਸਮ ਵਿੱਚ ਬਹੁਤ ਵਾਰੀ ਘਰ ਜਿਹੜਾ ਹੈਗਾ ਉਹ ਬਣਾਉਂਦੇ ਹਾਂ ਅਤੇ ਖਾਂਦੇ ਹਾਂ ਅਤੇ ਇਹਦੇ ਨਾਲ ਕੀ ਹੁੰਦਾ ਵੀ ਸਾਡੇ ਘਰਦਿਆਂ ਨੂੰ ਇਹ ਸਾਰਿਆਂ ਨੂੰ ਬਹੁਤ ਪਸੰਦ ਕਿਉਂਕਿ ਜਦੋਂ ਵੀ ਕੋਈ ਵੀ ਘਰ ਵਿੱਚ ਕੋਈ ਵੀ ਛੋਟਾ ਮੋਟਾ ਫੰਕਸ਼ਨ ਕਰਦਾ ਜਾਂ ਕੋਈ ਮੋ ਛੋਟਾ ਮੋਟਾ ਤਿਉਹਾਰ ਤਾਂ ਸਭ ਤੋਂ ਪਹਿਲਾਂ ਘਰ ਦੇ ਕਹਿਣਗੇ ਵੀ ਭਾਈ ਬੰਬ ਪਕੌੜੇ ਬਣਾ ਲਾ ਜਾਂ ਘਰ ਕੋਈ ਵੀ ਆਉਂਦਾ ਰਿਸ਼ਤੇਦਾਰ ਆਉਂਦਾ ਤਾਂ ਉਹ ਵੀ ਮੈਨੂੰ ਇਹ ਚੀਜ਼ ਬਾਰੇ ਜਦੋਂ ਮੇਰੇ ਤੋਂ ਇੱਕ ਵਾਰੀ ਖਾ ਲੈਂਦਾ ਨਾ ਤਾਂ ਫਿਰ ਮੈਨੂੰ ਫੋਨ ਕਰਕੇ ਕਹਿੰਦਾ ਅਸੀਂ ਆਵਾਂਗੇ ਤਾਂ ਤੂੰ ਬੰਬ ਪਕੌੜੇ ਬਣਾ ਕੇ ਰੱਖੀਂ ਤਾਂ ਉਹ ਐਡੇ ਵਧੀਆ ਤਰੀਕੇ ਨਾਲ ਮੈਂ ਬਣਾਉਂਦੀ ਹਾਂ ਤਾਂ ਮੈਨੂੰ ਚੰਗੇ ਲੱਗਦੇ ਆ ਉਹ ਬਣਾਉਣੇ ਅਤੇ ਖੁਸ਼ੀ ਵੀ ਮਿਲਦੀ ਆ ਵੀ ਕਿਉਂਕਿ ਉਹ ਸਾਰਿਆਂ ਨੂੰ ਇੰਨੇ ਪਸੰਦ ਆਉਂਦੇ ਅਤੇ ਉਹ ਮੈਨੂੰ ਦੂਰੀ ਵਰ ਦੂਰੀ ਵਰ ਕਹਿੰਦੇ ਆ ਵੀ ਮੈਨੂੰ ਉਹ ਬਣਾਉਣੇ ਚਾਹੀਦੇ ਹੈ ਅਤੇ ਬਣਾ ਕੇ ਰੱਖ ਅਤੇ ਉਹ ਨਾ ਬਾਹਲਾ ਸਰਦੀਆਂ ਦੇ ਮੌਸਮ 'ਚ ਤਾਂ ਅਸੀਂ ਦੂਜੇ ਤੀਜੇ ਦਿਨ ਹੀ ਬਣਾ ਲੈਂਦੇ ਅਤੇ ਗਰਮੀਆਂ 'ਚ ਕਈ ਵਾਰ ਮਹੀਨਾ ਵੀ ਪੈ ਜਾਂਦਾ ਹੁੰਦਾ ਕਿਉਂਕਿ ਗਰਮੀਆਂ 'ਚ ਜ਼ਿਆਦਾ ਗਰਮ ਚੀਜ਼ਾਂ ਨਹੀਂ ਖਾਧੀਆਂ ਜਾਂਦੀਆਂ ਤਲੀਆਂ ਫਲੀਆਂ ਅਤੇ ਮੇਰੀ ਜਿਹੜੀ ਪਸੰਦੀਦਾ ਰੈਸੀਪੀ ਕੀ ਆ ਉਹ ਬੰਬ ਪਕੌੜਾ ਅਤੇ ਮੈਨੂੰ ਬਣਾਉਣੀ ਵੀ ਉਹ ਬਹੁਤ ਪਸੰਦ ਆ ਅਤੇ ਖਾਣੀ ਅਤੇ ਖਵਾਉਣੀ ਦੋਨੇ ਹੀ ਬਹੁਤ ਪਸੰਦ ਆ ਥੈਂਕ ਯੂ